ਮੈਂ ਮਮਤਾ ਦੇਵੀ ਵਾਸੀ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਦੱਸਣ ਲੱਗੀ ਹਾਂ ਕਿ ਸਾਡੇ ਪੰਜਾਬ ਵਿੱਚ ਕੁਝ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਅਜਾਇਬ ਘਰ ਹਨ ਜੇਕਰ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤਾਂ ਸਾਡੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਅਜਾਇਬ ਘਰ ਕਲਾ ਕੇਂਦਰ ਹਨ ਜੋ ਸਾਨੂੰ ਪੁਰਾਣੇ ਸੰਸਕ੍ਰਿਤੀ ਦੀ ਤਸਵੀਰ ਦਿੰਦੇ ਹਨ ਜਿਸ ਤਰ੍ਹਾਂ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਅੱਜ ਕੱਲ ਜਿੱਥੇ ਵੀ ਕੋਈ ਧਾਰਮਿਕ ਕੇਂਦਰ ਹੈ ਉੱਥੇ ਅਜਾਇਬ ਘਰ ਦੀ ਜ਼ਰੂਰਤ ਹੁੰਦੀ ਹੈ ਜਾਂ ਲੋਕ ਉਸ ਨੂੰ ਪਸੰਦ ਕਰਦੇ ਹਨ ਜਿਸ ਤਰ੍ਹਾਂ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਲਾਹੌਰ ਅਜਾਇਬ ਘਰ ਲਾਹੌਰ ਵਿੱਚ ਇੱਕ ਇੱਕ ਅਜਾਇਬ ਘਰ ਸੀ ਜੋ ਕਿ ਅੱਜ ਵੀ ਸਾਡੀ ਕਈ ਤਰ੍ਹਾਂ ਦੀ ਸੰਸਕ੍ਰਿਤੀ ਨੂੰ ਸੰਭਾਲੀ ਬੈਠਾ ਹੈ ਜੇਕਰ ਮੈਂ ਗੱਲ ਕਰਾਂ ਤਾਂ ਪਟਿਆਲਾ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਕਿ ਸਾਨੂੰ ਦੇਖਣ ਨੂੰ ਮਿਲਦੀਆਂ ਹਨ ਫਿਰ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਜਿੱਥੇ ਇੱਕ ਵਿਰਾਸਤੀ ਅਜਾਇਬ ਘਰ ਬਣ ਚੁੱਕਿਆ ਹੈ ਜੋ ਕਿ ਰੰਗ ਬਿਰੰਗੀਆਂ ਫਿਲਮਾਂ ਦੇ ਨਾਲ ਭਰਿਆ ਹੈ ਉੱਥੇ ਜਾ ਕੇ ਸਾਡੀ ਸੰਸਕ੍ਰਿਤੀ ਸਾਰੀ ਹੀ ਪੁਰਾਤਨ ਸੰਸਕ੍ਰਿਤੀ ਦਾ ਪਤਾ ਲੱਗਦਾ ਹੈ ਇਸ ਤਰ੍ਹਾਂ ਸਾਡੇ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਛੋਟੀਆਂ ਮੋਟੀਆਂ ਕਈ ਤਰ੍ਹਾਂ ਦੀਆਂ ਲਾਈਬ੍ਰੇਰੀਆਂ ਅਜੀ ਅਜਾਇਬ ਘਰ ਦਾ ਜਾਂ ਕਲਾ ਕੇਂਦਰ ਥੀਏਟਰ ਮੌਜੂਦ ਹਨ ਜੋ ਸਾਡੀ ਸੰਸਕ੍ਰਿਤੀ ਨੂੰ ਸੰਭਾਲੇ ਬੈਠੇ ਹਨ ਅਸੀਂ ਉੱਥੋਂ ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਕਈ ਤਰ੍ਹਾਂ ਦੀਆਂ ਕਹਾਣੀਆਂ ਸਿੱਖ ਕੇ ਆਪਣੇ ਸਮੇਂ ਦੀ ਪੁਰਾਤਨ ਸਮੇਂ ਯਾਦ ਰੱਖਦੇ ਹਾਂ